ਸਮੇਂ ਦੇ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਜ਼ਿਆਦਾ ਬਦ ਬਦਲ ਗਈ ਹੈ ਲੋਕ ਪੰਜਾਬੀ ਪੰਜਾਬੀ ਤੋਂ ਜ਼ਿਆਦਾ ਇੰਗਲਿਸ਼ ਨੂੰ ਪ੍ਰੈਫਰ ਕਰ ਗਏ ਹਨ ਪਰ ਸਾਨੂੰ ਆਪਣੀ ਪੰਜਾਬੀ ਭਾਸ਼ਾ ਨਹੀਂ ਭੁੱਲਣੀ ਚਾਹੀਦੀ ਕਿਉਂਕਿ ਸਾਡੀ ਪੰਜਾਬੀ ਭਾਸ਼ਾ ਬੋਲਣ ਨਾਲ ਹੀ ਸਾਡਾ ਪੰਜਾਬ ਪੰਜਾਬ ਦਾ ਸੱਭਿਆਚਾਰ ਹੈ ਪੰਜਾਬੀ ਭਾਸ਼ਾ ਇੱਕ ਬਹੁਤ ਵਧੀਆ ਗਿਆਨ ਹਨ ਇਸ ਨੂੰ ਬੋਲਣ ਇਹ ਬੋਲਣ ਲਈ ਵੀ ਬਹੁਤ ਸੌਖੀ ਹੈ ਅਤੇ ਇਹ ਲੋਕ ਪਰ ਲੋਕ ਸਮਝਦੇ ਨਹੀਂ ਲੋਕ ਪੰਜਾਬੀ ਤੋਂ ਜ਼ਿਆਦਾ ਇੰਗਲਿਸ਼ ਨੂੰ ਇੰਗਲਿਸ਼ ਭਾਸ਼ਾ ਨੂੰ ਪ੍ਰੈਫਰ ਕਰਦੇ ਹਨ ਪਰ ਸਾਨੂੰ ਪੰਜਾਬੀ ਭਾਸ਼ਾ ਨਹੀਂ ਭੁੱਲਣੀ ਚਾਹੀਦੀ ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਜਗ੍ਹਾ 'ਤੇ ਹੁੰਦੀ ਹੈ ਪਰ ਕਈ ਲੋਕ ਇੰਗਲਿਸ਼ ਨੂੰ ਛੱਡ ਕੇ ਪੰਜਾਬੀ ਭਾਸ਼ਾ ਨੂੰ ਬਹੁਤ ਜ਼ਿਆਦਾ ਗਿ ਵੱਧ ਗਿਆਨ ਦਿੰਦੇ ਹਨ ਪੰ ਇਸ ਕਰਕੇ ਪੰਜਾਬੀ ਭਾਸ਼ਾ ਸਾਨੂੰ ਭੁੱਲਣੀ ਨਹੀਂ ਚਾਹੀਦੀ ਸਮੇਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ ਖ਼ਾਸ ਕਰਕੇ ਹੋਰ ਭਾਸ਼ਾਵਾਂ ਅਤੇ ਸੱਭਿਆਚਾਰ ਭਾਸ਼ਾਵਾਂ ਕਰਕੇ ਪੰਜਾਬੀ ਭਾਸ਼ਾ ਇੱਕ ਇਹੋ ਜਿਹੀ ਭਾਸ਼ਾ ਹੈ ਜਿਸ ਨਾਲ ਅਸੀਂ ਆਪਣੇ ਯਾਰ ਦੋਸਤ ਸੱਜਣ ਮਿੱਤਰ ਬਣਾਉਂਦੇ ਹਾਂ ਅਤੇ ਪੰਜਾਬੀ ਭਾਸ਼ਾ ਇੱਕ ਬਹੁਤ ਵਧੀਆ ਗਿਆਨ ਹੈ ਇਸ ਪੰਜਾਬੀ ਭਾਸ਼ਾ ਪੰਜਾਬੀਆਂ ਨੂੰ ਬੋਲ ਭੁੱਲਣੀ ਨਹੀਂ ਚਾਹੀਦੀ ਕਿਉਂਕਿ ਪੰਜਾਬ ਪੰਜਾਬ ਵਿੱਚ ਪੰਜਾਬੀ ਦਾ ਬਹੁਤ ਵੱਦ ਵੱਡਾ ਗਿਆਨ ਦਿੱਤਾ ਗਿਆ ਹੈ ਅਤੇ ਇਹ ਇੱਕ ਬਹੁਤ ਵੱਡੀ ਭਾਸ਼ਾ ਹੈ